ਮੈਂ ਰੰਗਾਂ ਨੂੰ ਰੰਗਣ ਲਈ ਦੋ ਰੰਗਾਂ ਨੂੰ ਆਪਸ ਵਿੱਚ ਮਿਕਸ ਕਰਦੀ ਹਾਂ ਜਿਸ ਰਾਹੀਂ ਤੀਜਾ ਰੰਗ ਬਣ ਜਾਂਦਾ ਹੈ ਅਤੇ ਇਹਨਾਂ ਦੀ ਵਰਤੋਂ ਮੈਂ ਵੱਖ ਵੱਖ ਤਰ੍ਹਾਂ ਕਰਦੀ ਹਾਂ